ਅੱਜ ਕੱਲ ਸੂਚਨਾ ਤਕਨੋਲੋਜੀ ਦਾ ਸਾਡੇ ਕੰਮ ਕਰਨ ਤਾਂ ਸੰਚਾਰ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਹੈਗਾ ਅਤੇ ਅੱਜ ਕੱਲ ਬੈਂਕ ਦੇ ਕੰਮ ਹੀ ਲੈ ਲਓ ਤੁਸੀਂ ਪਹਿਲਾਂ ਜਦੋਂ ਪੈਸੇ ਕਢਾਉਂਦੇ ਹੁੰਦੇ ਸੀ ਫਿਰ ਟੋਕਨ ਲੈਣਾ ਪੈਂਦਾ ਸੀ ਲਾਈਨ 'ਚ ਖੜਾ ਕਰਨਾ ਪੈਂਦਾ ਸੀਗਾ ਫਿਰ ਕੈਸ਼ੀਅਰ ਕੀ ਕਰਦਾ ਸੀ ਟੋਕਨ ਲੈਂਦਾ ਸੀਗਾ ਗਿਣਦਾ ਸੀ ਪੈਸੇ ਅਤੇ ਉਹ ਫਿਰ ਦੁਬਾਰਾ ਆਪਣਾ ਗਿਣ ਨੂੰ ਲੈਂਦਾ ਸੀਗਾ ਅਤੇ ਇਧਰ ਬਹੁਤ ਟਾਈਮ ਲੱਗਦਾ ਸੀਗਾ ਪੈਸੇ ਕਢਾਉਣ ਦੇ ਵਿੱਚ ਅਤੇ ਅੱਜ ਕੱਲ੍ਹ ਏ ਟੀ ਐੱਮ ਖੁੱਲ੍ਹ ਗਏ ਹੈਗੇ ਆ ਤੁਹਾਡੇ ਕੋਲ ਏ ਟੀ ਐੱਮ ਕਾਰਡ ਹੋਵੇ ਅਤੇ ਜਾਂ ਉਹ ਅੱਜ ਕੱਲ੍ਹ ਅੰਗੂਠੇ ਤੋਂ ਦੇ ਨਿਸ਼ਾਨ ਦੇ ਦੁਆਰਾ ਤੁਹਾਡੇ ਪੈਸੇ ਨਿਕਲ ਜਾਂਦੇ ਹਨ ਅਤੇ ਇਸ ਨਾਲ ਬਹੁਤ ਕੰਮ ਆਸਾਨ ਹੋ ਗਿਆ ਹੈ ਜਿਹੜਾ ਕਿ ਪਹਿਲਾਂ ਪੋਸੀਬਲ ਹੀ ਨਹੀਂ ਸੀ ਅਤੇ ਦੂਸਰਾ ਨੰਬਰ 'ਤੇ ਈ ਮੇਲ ਦੀ ਵਰਤੋਂ ਆ ਗਈ ਹੈਗੀ ਆ ਪਹਿਲਾਂ ਇੱਕ ਚਿੱਠੀ ਭੇਜਣੀ ਹੁੰਦੀ ਸੀ ਕਿਸੇ ਮਹਿਕਮੇ ਨੂੰ ਦੂਜੇ ਮਹਿਕਮੇ ਤੱਕ ਉਹ ਚਿੱਠੀ ਪਹੁੰਚਦੇ ਪਹੁੰਚਦੇ ਨੇ ਕਈ ਵਾਰ ਹਫਤਾ ਦਸ ਦਿਨ ਵੀਹ ਦਿਨ ਲੱਗ ਜਾਂਦੇ ਸੀਗੇ ਅਤੇ ਬਾਅਦ 'ਚੋਂ ਜਿਹੜਾ ਚਿੱਠੀ ਹੈਗੀ ਉਹਦਾ ਜਵਾਬ ਲੈਣ ਨੂੰ ਬਹੁਤ ਟਾਈਮ ਲੱਗ ਜਾਂਦਾ ਸੀਗਾ ਅਤੇ ਈ ਮੇਲ ਨਾਲ ਕੀ ਹੋ ਗਿਆ ਹੁਣ ਉਹ ਕੰਮ ਸਾਡਾ ਸੈਕਿੰਡ ਵਿੱਚ ਹੀ ਹੋ ਗਿਆ ਸਾਨੂੰ ਨਾਲ ਹੀ ਰਿਸਿਪਟ ਮਿਲ ਜਾਂਦੀ ਹੈਗੀ ਅਤੇ ਅਸੀਂ ਪੰਜਾਹ ਜਣਿਆਂ ਨੂੰ ਸੌ ਜਣਿਆਂ ਨੂੰ ਹਜ਼ਾਰ ਜਣਿਆਂ ਨੂੰ ਭੇਜ ਸਕਦੇ ਈ ਮੇਲ ਅਤੇ ਦੂਸਰਾ ਨੰਬਰ ਅੱਜ ਕੱਲ੍ਹ ਵਟਸਐਪ ਤਕਨੀਕ ਆ ਗਈ ਹੈਗੀ ਆ ਗਰੁੱਪ ਬਣ ਜਾਂਦੇ ਨੇ ਉਹਦੇ ਵਿੱਚ ਅਤੇ ਕੋਈ ਵੀ ਸੂਚਨਾਂ ਦੇਣੀ ਹੋਵੇ ਤਾਂ ਉਹ ਸਾਰੇ ਗਰੁੱਪ ਨੂੰ ਪਹੁੰਚ ਜਾਂਦੀ ਹੈ ਸੂਚਨਾ ਅਤੇ ਜੋ ਕਿ ਪਹਿਲਾਂ ਇਹ ਚੀਜ਼ ਬਹੁਤ ਮੁਸ਼ਕਿਲ ਸੀਗੀ ਅਤੇ ਲੋਕ ਵੀ ਅੱਜ ਕੱਲ੍ਹ ਉਹ ਚਿੱਠੀਆਂ ਭੇਜਣੀਆਂ ਹੋਣ ਉਹ ਈ ਮੇਲ ਰਾਹੀਂ ਹੀ ਭੇਜਦੇ ਹਨ